ਮੈਂ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਹਾਂ ਮੈਂ ਜਦੋਂ ਵੀ ਕਿਸੇ ਵਿਆਹ ਸ਼ਾਦੀ ਜਾਂ ਕਿਸੇ ਵੀ ਫੰਕਸ਼ਨ 'ਤੇ ਜਾਂਦੀ ਹਾਂ ਤਾਂ ਮੈਂ ਆਪਣੀਆਂ ਤਸਵੀਰਾਂ ਲੈਂਦੀ ਹਾਂ ਮੈਨੂੰ ਤਸਵੀਰਾਂ ਖਿੱਚਣੀਆਂ ਬਹੁਤ ਪਸੰਦ ਹਨ ਕਿਉਂਕਿ ਮੈਂ ਜਦੋਂ ਵੀ ਆਪਣੀਆਂ ਜਾਂ ਆਪਣੇ ਸਾਥੀਆਂ ਨਾਲ ਤਸਵੀਰਾਂ ਲੈਂਦੀ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਉਹ ਮੇਰੇ ਕੋਲ ਯਾਦਾਂ ਰਹਿ ਜਾਂਦੀਆਂ ਹਨ ਜਦੋਂ ਮੈਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਹਾਂ ਮੈਨੂੰ ਬਹੁਤ ਸਾਰੇ ਲਾਈਕ ਵਿਊ ਆਉਂਦੇ ਹਨ ਮੈਨੂੰ ਬਹੁਤ ਲੋਕੀ ਵਧੀਆ ਵਧੀਆ ਕਮੈਂਟ ਕਰਦੇ ਹਨ ਅਤੇ ਮੈਨੂੰ ਇਹ ਸਾਰਾ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੀਆਂ ਤਸਵੀਰਾਂ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਲੈਂਦੀ ਹਾਂ ਤਾਂ ਮੈਂ ਇਹ ਸੋਚਦੀ ਹਾਂ ਕਿ ਜਦੋਂ ਅਸੀਂ ਬਹੁਤ ਬਜ਼ੁਰਗ ਹੋ ਜਾਵਾਂਗੇ ਤਾਂ ਅਸੀਂ ਇਹ ਸਾਰੀਆਂ ਤਸਵੀਰਾਂ ਦੇਖ ਕੇ ਖੁਸ਼ ਹੋਵਾਂਗੇ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਜਗ੍ਹਾ ਗਏ ਅਸੀਂ ਤਸਵੀਰਾਂ ਲੈਂਦੇ ਸਮੇਂ ਹਮੇਸ਼ਾ ਖੁਸ਼ ਹੁੰਦੇ ਹਾਂ ਸਾਡੇ ਚਿਹਰਿਆਂ ਉੱਪਰ ਹਮੇਸ਼ਾ ਖੁਸ਼ੀ ਰਹਿੰਦੀ ਹੈ ਸਾਨੂੰ ਇਹ ਸਭ ਪੋਸਟ ਕਰਨਾ ਬਹੁਤ ਵਧੀਆ ਲੱਗਦਾ ਹੈ